ਜਿਵੇਂ ਕਿ ਆਪਾਂ ਬਾਗਬਾਨੀ ਦੀ ਗੱਲ ਕਰੀਏ ਤਾਂ ਅਸੀਂ ਉਹਦੇ ਅਲੱਗ ਅਲੱਗ ਕਿਸਮ ਦੇ ਜੋ ਪੌਦੇ ਨੇ ਜਿਵੇਂ ਅਮਰੂਦ ਚੀਕੂ ਕਿੰਨੂ ਅਨਾਰ ਜਾਮਣ ਅਤੇ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਪੌਦੇ ਨੇ ਉਹ ਘਰ ਲਾਏ ਹੋਏ ਨੇ ਬਾਗਬਾਨੀ ਵਾਸਤੇ ਘਰ ਉਹਨਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਈ ਪੌਦੇ ਇਸ ਤਰ੍ਹਾਂ ਦੇ ਨੇ ਜਿਵੇਂ ਜਾਮਣ ਵਗੈਰਾ ਨੇ ਇਹਨਾਂ ਨੂੰ ਕੀ ਹੁੰਦਾ ਜਾਮਣ ਵਿੱਚੋਂ ਕਈ ਵਾਰ ਕੀ ਹੋਣ ਲੱਗ ਜਾਂਦੀ ਹੈ ਵਿੱਚੋਂ ਖਰਾਬ ਨਿਕਲਣ ਲੱਗ ਜਾਂਦੀ ਆ ਜਦੋਂ ਆਪਾਂ ਉਹਨੂੰ ਖਾਂਦੇ ਹਾਂ ਤਾਂ ਵਿੱਚੋਂ ਉਹਦੇ ਵਿੱਚ ਕਈ ਵਾਰ ਕੀੜੇ ਹੁੰਦੇ ਨੇ ਤਾਂ ਉਹਨੂੰ ਦੇਖਦੇ ਹਾਂ ਆਪਾਂ ਜਦੋਂ ਉਹਦੀ ਜੜ੍ਹ ਦੇ ਵਿੱਚ ਆਪਾਂ ਕਲੋਰੋ ਸਪਰੇ ਪਾਣੀ ਦੇ ਵਿੱਚ ਘੋਲ ਕੇ ਪਾ ਦਿੰਦੇ ਹਾਂ ਤਾਂ ਕੁਛ ਸਮੇਂ ਬਾਅਦ ਕੰਟਰੋਲ ਹੋ ਜਾਂਦੀ ਆ ਕਰਕੇ ਵੀ ਦੇਖਿਆ ਹੋਇਆ ਅਸੀਂ ਤਾਂ ਕੀੜੇ ਕੰਟਰੋਲ ਹੋ ਜਾਂਦੇ ਨੇ ਉਹ ਜਾਮਣਾਂ ਸਹੀ ਹੋ ਜਾਂਦੀਆਂ ਨੇ ਜਿਹੜੀਆਂ ਨਵੀਆਂ ਆਉਂਦੀਆਂ ਨੇ ਆਈਂ ਅਮਰੂਦਾਂ ਦੇ ਵਿੱਚ ਜਿਵੇਂ ਅਮਰੂਦਾਂ ਦੇ ਵਿੱਚ ਅਮਰੂਦਾਂ ਵਾਲੀ ਮੱਖੀ ਆਉਂਦੀ ਆ ਉਹਦੇ ਵਿੱਚ ਵੀ ਅਮਰੂਦਾਂ ਦੀ ਜੜ੍ਹ ਖਰਾਬ ਹੋਣ ਲੱਗਦੀਆਂ ਜੁ ਉਹਦੇ ਵਿੱਚ ਜਾਲਾ ਪੈ ਜਾਂਦਾ ਜਾਂ ਉਹਦੇ ਵਿੱਚ ਨਮਕ ਪਾ ਦਿੰਦੇ ਆ ਜਾਂ ਕਲੀ ਪਾ ਦਿੰਦੇ ਆ ਉਹਦੇ ਨਾਲ ਵੀ ਦੁਬਾਰਾ ਫਲ ਬਹੁਤ ਵਧੀਆ ਚੱਕ ਲੈਂਦੇ ਨੇ ਬੂਟੇ ਤਾਂ ਉਹਦੇ ਨਾਲ ਵੀ ਕੰਟਰੋਲ ਹੋ ਜਾਂਦੇ ਨੇ ਜਿਹੜੇ ਅਮਰੂਦ ਝੜਦੇ ਹੁੰਦੇ ਉਹ ਵੀ ਹਟ ਜਾਂਦੇ ਨੇ ਅਮਰੂਦਾਂ ਨੂੰ ਕੀੜਾ ਲੱਗਦਾ ਉਹ ਵੀ ਹਟ ਜਾਂਦਾ ਉਹਦੇ ਨਾਲ ਤਾਂ ਬਹੁਤ ਵਧੀਆ ਕੰਟਰੋਲ ਹੋ ਜਾਂਦਾ ਇਹਨਾਂ ਦੇ ਵਿੱਚ ਬਾਗਬਾਨੀ ਦੇ ਵਿੱਚ ਕਲੀ ਨਾਲ ਵੀ